ਨਮਸਕਾਰ ਮੇਰਾ ਨਾਮ ਪੂਜਾ ਦੇਵੀ ਹੈ ਅਤੇ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਸਾਡੇ ਪਿੰਡ ਵਿੱਚ ਡੇਅਰੀ ਦਾ ਬਿਜਨਸ ਕੀਤਾ ਜਾਂਦਾ ਹੈ ਜੋ ਕਿ ਦੁੱਧ ਦਹੀਂ ਪਨੀਰ ਵਗੈਰਾ ਉੱਥੇ ਆਸਾਨੀ ਨਾਲ ਮਿਲ ਜਾਂਦਾ ਹੈ ਔਰ ਵੀ ਸਾਡੇ ਪਿੰਡ ਵਿੱਚ ਸਿਲਾਈ ਸੈਂਟਰ ਵੀ ਹੈ ਜਗ੍ਹਾ ਜਗ੍ਹਾ 'ਤੇ ਸਿਲਾਈ ਸੈਂਟਰ ਵੀ ਹੈ ਔਰ ਟਿਊਸ਼ਨਾਂ ਪੜ੍ਹਾਉਣ ਲਈ ਵੀ ਸੈਂਟਰ ਹੈ ਸਾਡੇ ਪਿੰਡ ਵਿੱਚ ਅਲੱਗ ਅਲੱਗ ਜਗ੍ਹਾ 'ਤੇ ਖੁੱਲ੍ਹੇ ਹੋਏ ਸਨ ਜੋ ਕਿ ਬੱਚਿਆਂ ਨੂੰ ਜ਼ਿਆਦਾ ਦੂਰ ਜਾਣਾ ਨਾ ਪਏ ਸ਼ਹਿਰ ਵਿੱਚ ਜਾ ਕੇ ਬੱਚਿਆਂ ਨੂੰ ਪੜ੍ਹਾਉਣ ਲਈ ਜਾਣਾ ਨਾ ਪਏ ਅਤੇ ਸਾਡੇ ਪਿੰਡ ਵਿੱਚ ਸ਼ੋਪਿੰਗ ਮੋਲ ਵੀ ਹੈ ਜੋ ਕਿ ਉੱਥੇ ਹਰ ਕੋਈ ਸਮਾਨ ਸਾਨੂੰ ਪਿੰਡ ਵਿੱਚ ਹੀ ਮਿਲ ਜਾਂਦਾ ਹੈ ਸ਼ੋਪਿੰਗ ਦੇ ਨਾਲ ਨਾਲ ਸਾਡੇ ਪਿੰਡ ਵਿੱਚ ਹਲਵਾਈ ਦੀਆਂ ਦੁਕਾਨਾਂ ਵੀ ਹੈ ਜੋ ਕਿ ਸਾਨੂੰ ਪਿੰਡ ਵਿੱਚੋਂ ਹੀ ਹਰ ਕੋਈ ਸਮਾਨ ਮਿਲ ਜਾਂਦਾ ਹੈ ਔਰ ਸਾਨੂੰ ਸ਼ਹਿਰ ਜਾ ਕੇ ਖਰੀਦਣ ਦੀ ਜ਼ਰੂਰਤ ਨਹੀਂ ਪੈਂਦੀ ਸ਼ੋਪਿੰਗ ਦੇ ਨਾਲ ਨਾਲ ਸਾਡੇ ਪਿੰਡ ਵਿੱਚ ਗਰਾਮੀਣ ਬੈਂਕ ਵੀ ਹੈ ਜਿੱਥੇ ਅਸੀਂ ਪਿੰਡ ਵਿੱਚ ਹੀ ਜਾ ਕੇ ਪੈਸੇ ਵਗੈਰਾ ਜਮ੍ਹਾਂ ਕਢ ਕਰਵਾ ਸਕਦੇ ਹਾਂ ਕਢਵਾ ਸਕਦੇ ਹਾਂ ਸਾਨੂੰ ਇੱਥੇ ਸਭ ਸਹੂਲਤਾਂ ਮਿਲੀਆਂ ਹੋਈਆਂ ਹਨ